ਹੈਲੋ ਹਾਂਜੀ ਮੁਕੇਸ਼ ਕੈਟ੍ਰਿੰਗ ਜੀ ਹਾਂਜੀ ਸਾਡੇ ਨਾ ਬੇਟੇ ਦਾ ਮੈਰੀਜ ਹੈ ਜੀ ਉਹ ਉਹ ਫੰਕਸ਼ਨ ਲਈ ਕਰਨਾ ਸੀ ਅਤੇ ਚਾਰ ਸੌ ਬੰਦਿਆਂ ਦਾ ਰੇਂਜਮੈਂਟ ਹੈ ਦੱਸੋ ਤੁਸੀਂ ਆਪਣਾ ਐਸਟੀਮੇਟ ਵੀ ਤਰੀਕ ਸਾਡੀ ਹੈਗੀ ਹੈ ਜੀ ਫਰਵਰੀ ਦੀ ਹੈ ਜੀ ਸਾਨੂੰ ਇਹਦਾ ਲੇਡੀਜ਼ ਸੰਗੀਤ ਲਈ ਚਾਹੀਦਾ ਹੈ ਅਤੇ ਚਾਰ ਸੌ ਹਾਂ ਚਾਰ ਸੌ ਬੰਦਿਆਂ ਦਾ ਅਰੇਂਜਮੈਂਟ ਹੈ ਮੈਕਸ ਹੋ ਜਾਣ ਅੱਠ ਦੱਸ ਅਤੇ ਕੋਲਡ੍ਰਿੰਕ ਹੋ ਜਾਵੇਗਾ ਹੋਰ ਕੌਫ਼ੀ ਵਗੈਰਾ ਠੀਕ ਹੈ ਨਾ ਅਤੇ ਪਲੱਸ ਰੋਟੀਆਂ ਉਹ 'ਚ ਦੱਸਿਓ ਤੁਸੀਂ ਵੀ ਕਿੰਨੀਆਂ ਆਈਟਮਾਂ ਕਰ ਸਬਜ਼ੀ ਦੀਆਂ ਰੱਖ ਲਉ ਚਾਰ ਪੰਜ ਆਈਟਮਾਂ ਨਹੀਂ ਨਹੀਂ ਕਮਿਊਨਿਟੀ ਸੈਂਟਰ 'ਚ ਕਰਾਂਗੇ ਅਸੀਂ ਤਾਂ ਟੈਂਟ ਵਗੈਰਾ ਦਾ ਵੀ ਦੱਸ ਦਿਉ ਕਿੱਦਾਂ ਹੈ ਤੁਹਾਡਾ ਕਿਆ ਅਰੇਂਜਮੈਂਟ ਹੈ ਨਹੀਂ ਅਸੀਂ ਇੱਦਾਂ ਹੀ ਦੱਸੋ ਤੁਸੀਂ ਚਾਰ ਸੌ ਬੰਦਿਆਂ ਦਾ ਦੱਸੋ ਪਲੇਟ ਸਿਸਟਮ ਦਾ ਵੀ ਦੱਸ ਦਿਉ ਦੋਨੋਂ ਦੱਸ ਦਿਉ ਸਾਨੂੰ ਅੱਛਾ ਜੀ ਅਤੇ ਉਂਝ ਜੇ ਕਰਨਾ ਹੋਵੇ ਉੱਕਾ ਚੁੱਕਾ ਕਰਨਾ ਹਾਂਜੀ ਸਨੈਕਸ ਹਾਂਜੀ ਹਾਂਜੀ ਫਰੂਟ ਚਾਟ ਵੀ ਜੀ ਅਤੇ ਦੱਸੋ ਹੁਣ ਆਪਣਾ ਤੁਸੀਂ ਕੀ ਹੈ ਤੁਹਾਡਾ ਇਹਦਾ ਹੈਲੋ ਠੀਕ ਠੀਕ ਓਕੇ ਚਲੋ ਆਉਂਦੇ ਹਾਂ ਜੀ ਫੇਰ ਅਸੀਂ ਠੀਕ ਹੈ ਓਕੇ